ਮੇਰੇ ਖਿਆਲ ਵਿੱਚ ਕਲਾ ਮੇਲਾ ਕਲਾ ਉਤਸਵ ਕਵੀ ਸੰਮੇਲਨ ਸੰਗੀਤ ਸੰਧਿਆ ਪਰ ਹੋਰ ਵੀ ਕਈ ਵਰਗੇ ਸਮਾਗਮ ਨੇ ਜਿੱਥੇ ਕਲਾਕਾਰ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਵਰਤੇ ਜਾ ਸਕਦੇ ਹੈ ਜਿਵੇਂ ਕਿ ਕਲਾ ਮੇਲਾ ਕਲਾ ਮੇਲਾ ਇੱਕ ਐਸਾ ਅਵਸਰ ਹੈ ਜਿੱਥੇ ਕਈ ਤਰ੍ਹਾਂ ਦੇ ਕਲਾਕਾਰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰ ਸਕਦੇ ਹਨ ਇਸ ਮੇਲੇ ਵਿੱਚ ਪੇਂਟਿੰਗ ਹੈਂਡੀਕਰਾਫਟਸ ਅਤੇ ਹੋਰ ਕਲਾ ਦੀ ਢੇਰ ਸਾਰੀਆਂ ਦਿਖਾਵਾਂ ਹੁੰਦੀਆਂ ਹਨ ਹਰ ਕਲਾ ਦੇ ਸ਼ਿਲਪਕਾਰ ਆਪਣੇ ਆਪਣੇ ਕੰਮ ਨੂੰ ਵਿਖਾਉਂਦੇ ਹੈ ਅਤੇ ਲੋਕਾਂ ਨੂੰ ਉਹਨਾਂ ਦੀ ਕਲਾ ਦੀ ਕਦਰ ਕਰਨ ਲਈ ਮੌਕਾ ਪ੍ਰਦਾਨ ਕਰਦੇ ਹੈ ਕਲਾ ਉਤਸਵ ਕਲਾ ਉਤਸਵ ਇੱਕ ਫੈਸਟੀਵਲ ਜਾਂ ਸਮਾਗਮ ਹੈ ਜਿੱਥੇ ਵੀਭਿੰਨ ਕਲਾਵਾਂ ਦੇ ਪ੍ਰਦਰਸ਼ਨ ਕੀਤੇ ਜਾਂਦੇ ਹੈ ਇਸੇ ਉਤਸਵ ਵਿੱਚ ਰੰਗ ਮੰਚ ਸੰਗੀਤ ਕਵਿਤਾਏ ਦੇ ਹੋਰ ਕਲਾ ਦੇ ਪ੍ਰਦਰਸ਼ਨ ਹੁੰਦੇ ਹੈ ਔਰ ਕਵੀ ਸੰਮੇਲਨ ਕਵੀ ਸੰਮੇਲਨ ਵਿੱਚ ਕਵਿਤਾ ਸ਼ਾਇਰੀ ਅਤੇ ਦੂਸਰੇ ਕਲਾ ਕਲਾਉਣ ਦਾ ਪ੍ਰਦਰਸ਼ਨ ਕੀਆ ਜਾਂਦਾ ਹੈ ਇਹ ਇੱਕ ਸੁੰਦਰ ਮਾਹੌਲ ਹੈ ਜਿੱਥੇ ਕਲਾਕਾਰ ਆਪਣੀ ਕਵਿਤਾ ਜਾਂ ਸ਼ਾਇਰੀ ਨੂੰ ਲੋਕਾਂ ਨਾਲ ਸਾਂਝ ਕਰ ਸਕਦਾ ਹੈ